ਹੈਲੋ ਸਤਿ ਸ਼੍ਰੀ ਅਕਾਲ ਸਰ ਤੁਸੀਂ ਕਿਵੇਂ ਹੋ ਜੀ ਮੈਨੂੰ ਉਮੀਦ ਆ ਤੁਸੀਂ ਠੀਕ ਹੋਵੋਗੇ ਸਰ ਮੈਂ ਸੁਣਿਆ ਹੈ ਕਿ ਤੁਸੀਂ ਆਪਣੇ ਪਰਿਵਾਰ ਵਿੱਚ ਵਾਧਾ ਕਰਨ ਜਾ ਰਹੇ ਹੋ ਇਹ ਬਹੁਤ ਹੀ ਵਧੀਆ ਗੱਲ ਹੈ ਤੁਹਾਨੂੰ ਇਸ ਗੱਲ ਦੀਆਂ ਬਹੁਤ ਬਹੁਤ ਮੁਬਾਰਕਾਂ ਸਰ ਮੈਂ ਤੁਹਾਨੂੰ ਇਸ ਬਾਰੇ ਕੁਝ ਜਾਣਕਾਰੀ ਦੇਣਾ ਚਾਹੁੰਦੀ ਹਾਂ ਕਿ ਮੈਂ ਤੁਹਾਡੇ ਦੋ ਚਾਰ ਮਿੰਟ ਲੈ ਸਕਦੀ ਹਾਂ ਥੈਂਕ ਯੂ ਸਰ ਮੈਨੂੰ ਆਪਣਾ ਕੀਮਤੀ ਸਮਾਂ ਦੇਣ ਲਈ ਸਰ ਨਵੇਂ ਪਰਿਵਾਰ ਦੀ ਸ਼ੁਰੂਆਤ ਕਰਨ ਲਈ ਇਕ ਨਵਾਂ ਬੱਚਾ ਆਪਣੇ ਜੀਵਨ ਵਿੱਚ ਲਿਆਉਣ ਲਈ ਬਹੁਤ ਤਰ੍ਹਾਂ ਦੀਆਂ ਯੋਜਨਾਵਾਂ ਹਨ ਜੋ ਕਿ ਇੱਕ ਮਹਿਲਾ ਨੂੰ ਦਿੱਤੀਆਂ ਜਾਣ ਜੋ ਕਿ ਇੱਕ ਮਹਿਲਾ ਨੂੰ ਦਿੱਤੀਆਂ ਜਾਂਦੀਆਂ ਹਨ ਏ ਬਹੁਤ ਸਾਰੇ ਸਿਹਤ ਬੀਮੇ ਹਨ ਜੋ ਕਿ ਸਾਡੇ ਪਰਿਵਾਰ ਲਈ ਸਾਡੇ ਹੋਣ ਵਾਲੇ ਬੱਚੇ ਲਈ ਬੱਚੇ ਲਈ ਹਨ ਜਿਹਨਾਂ ਨੂੰ ਸਾਨੂੰ ਜਿਹਨਾਂ ਬਾਰੇ ਸਾਨੂੰ ਜ਼ਿਆਦਾਤਰ ਜਾਣਕਾਰੀ ਨਹੀਂ ਹੁੰਦੀ ਇਸ ਲਈ ਮੈਂ ਤੁਹਾਨੂੰ ਉਹਨਾਂ ਬਾਰੇ ਦੱਸਣਾ ਚਾਹੁੰਦੀ ਹਾਂ ਜੇ ਤੁਹਾਡੇ ਜੇ ਤੁਹਾਡੇ ਪੈ ਪਹਿਲਾਂ ਬੱਚਾ ਲੜਕੀ ਹੁੰਦੀ ਹੈ ਤਾਂ ਤੁਹਾਨੂੰ ਆ ਤਾਂ ਤੁਹਾਨੂੰ ਸਾ ਬੱਚੇ ਨ ਤਾਂ ਤੁਹਾਨੂੰ ਪਹਿ ਪਹਿਲੀ ਲੜਕੀ ਹੋਣ ਦੇ ਪਹਿਲੇ ਜੇ ਲੜਕੀ ਹੁੰਦੀ ਹੈ ਤਾਂ ਤੁਹਾਨੂੰ ਪੈਂਤੀ ਸੌ ਰੁਪੀਆ ਐਜ਼ ਅ ਗੌਰਮੈਂਟ ਦੁਆਰਾ ਦਿੱਤਾ ਜਾਵੇਗਾ ਪਹਿਲਾ ਬੱਚਾ ਲੜਕੀ ਹੋਣ ਲਈ ਜੋ ਕਿ ਇੱਕ ਸਰਕਾਰ ਦੀ ਇੱਕ ਸਕੀਮ ਹੈ ਜਿਸ ਨਾਲ ਬੱਚੀਆਂ ਦੀ ਗਿਣਤੀ ਵਿੱਚ ਵਾਧਾ ਕੀਤਾ ਜਾ ਸਕੇ ਇਸ ਤੋਂ ਇਲਾਵਾ ਹੋਰ ਵੀ ਵੱਖ ਵੱਖ ਤਰ੍ਹਾਂ ਦੀਆਂ ਸਕੀਮਾਂ ਹਨ ਪੋਲਸੀਆਂ ਹਨ ਜੋ ਕਿ ਸਰਕਾਰ ਦੁਆਰਾ ਦਿੱਤੀਆਂ ਜਾਂਦੀਆਂ ਹਨ ਸਿਹਤ ਬੀਮੇ ਬੱਚਿਆਂ ਦੇ ਜਨਮ ਤੋਂ ਤੋਂ ਹੀ ਕਰਵਾਏ ਜਾਂਦੇ ਹਨ ਜੋ ਕਿ ਬਹੁਤ ਹੀ ਜ਼ਰੂਰੀ ਹਨ ਇਸ ਲਈ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਤੁਸੀਂ ਬੱਚੇ ਦੇ ਜਨਮ ਤੋਂ ਹੀ ਉਸਦਾ ਸਿਹਤ ਬੀਮਾ ਕਰਵਾਓ ਅਤੇ ਉਸਦਾ ਸਾਰਾ ਚੈੱਕਅਪ ਕਰਵਾਓ ਜੇਕਰ ਉਹ ਉਸਨੂੰ ਕੋਈ ਜਾ ਕੋਈ ਵੀ ਬਿਮਾਰੀ ਹੁੰਦੀ ਹੈ ਤਾਂ ਉਸਦਾ ਬਿਲਕੁਲ ਫਰੀ ਫਰੀ ਇਲਾਜ ਕੀਤਾ ਜਾਵੇਗਾ ਉਸ ਦੇ ਨਾਲ ਨਾਲ ਉਸਦੀ ਮਦਰ ਦਾ ਵੀ ਫਰੀ ਇਲਾਜ ਕੀਤਾ ਜਾਵੇਗਾ ਜੋ ਕਿ ਇੱਕ ਸਕੀਮ ਦੇ ਤਹਿਤ ਹੀ ਹੁੰਦਾ ਹੈ ਜਿਸ ਵਿੱਚ ਤੁਹਾਡਾ ਕੋਈ ਵੀ ਖਰਚਾ ਨਹੀਂ ਹੁੰਦਾ ਸੋ ਸਰ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰੀ ਗੱਲ ਸਮਝ ਆਈ ਹੋਵੇਗੀ ਆਈ ਹੋਪ ਤੁਸੀਂ ਇਹ ਸ ਬੀਮਾ ਜਰੂਰ ਕਰਵਾਉਗੇ ਥੈਂਕ ਯੂ ਸਰ